ਸਾਡੇ ਪਿੰਡ ਵਿੱਚ ਬਹੁਤ ਸਾਰੇ ਨੁਕਸੇ ਆ ਭਾਰ ਘਟਾਉਣ ਵਾਸਤੇ ਕੋਈ ਉਹ ਸਵੇਰੇ ਸਵੇਰੇ ਕੋਈ ਚਾਹ ਪੀਂਦਾ ਹੈਗਾ ਕਾਲੀ ਚਾਹ ਪੀਂਦਾ ਹੈ ਕੋਈ ਕੋਈ ਗਰੀਨ ਟੀ ਪੀਂਦਾ ਹੈ ਕੋਈ ਦੂਜਾ ਭਾਰ ਘਟਾਉਣ ਵਾਸਤੇ ਜਿੱਦਾਂ ਮਤਲਬ ਕਿ ਫਲ ਫਰੂਟ ਖਾਂਦੇ ਆ ਰੋਟੀ ਜਿੱਥੇ ਤਿੰਨ ਟਾਈਮ ਖਾਂਦੇ ਉੱਥੇ ਇੱਕ ਟਾਈਮ ਖਾਂਦੇ ਆ ਐਕਸਰਸਾਈਜ਼ ਕਰਦੇ ਆ ਯੋਗਾ ਕਰਦੇ ਆ ਤਾਂ ਫਿਰ ਉਹ ਦੂਸਰਾ ਫਲ ਫਰੂਟ ਖਾਂਦੇ ਆ ਸਲਾਦ ਸਲੂਦ ਖਾਂਦੇ ਆ ਜੂਸ ਜਾਸ ਪੀ ਓ ਦੂਜਾ ਪੀ ਲੈਂਦੇ ਆ ਹੋਰ ਕਈ ਵੀ ਭਾਰ ਪੌੜੀਆਂ ਪੁੜੀਆਂ ਚੜ੍ਹਦੇ ਭਾਰ ਘਟਾਉਣ ਨੂੰ ਸੈਰ ਕਰਦੇ ਆ ਤਾਂ ਵੀ ਉਹ ਦੂਸਰਾ ਨਿੰਬੂ ਪਾਣੀ ਵੀ ਪੀਂਦੇ ਹਨ ਗਰਮ ਪਾਣੀ ਪੀਂਦੇ ਆ ਸੇਬ ਦਾ ਸਿਰਕਾ ਮਤਲਬ ਕਿ ਸਭ ਕੁਝ ਜਿੱਦਾਂ ਕੋਈ ਨਿੰਬੂ ਪਾਣੀ ਸਵੇਰ ਨੂੰ ਜਿੱਦਾਂ ਗਰਮ ਪਾਣੀ ਪੱਤੀ ਵਿੱਚ ਪਾ ਕੇ ਉਹ ਕਾਹਵਾ ਜਿਹਾ ਉਹ ਬਣਾ ਕੇ ਕਾਲੀ ਚਾਹ ਪੀਂਦੇ ਨਿੰਬੂ ਨਿਚੋੜ ਕੇ ਵਿੱਚ ਤਾਂ ਬਹੁਤ ਸਾਰੇ ਨੁਕਸੇ ਹੈ ਇੱਥੇ ਬਾਰੇ ਸਾਡੇ ਪਿੰਡ ਵਿੱਚ ਤਾਂ ਬਹੁਤ ਸਾਰੇ ਬਹੁ ਐਕਸਰਸਾਈਜ਼ ਕਰਦੇ ਹੈ ਨਾਲੇ ਦੂਜਾ ਸੈਰ ਵੀ ਕਰਦੇ ਯੋਗਾ ਵੀ ਕਰਦੇ ਆ ਦੂਜਾ ਫਿਰ ਆਹ ਓ ਕੋਠੇ 'ਤੇ ਘੁੰਮਦਾ ਕੋਈ ਜਿੱਦਾਂ ਕੋਈ ਬਾਹਰ ਸੈਰ ਕਰਨ ਜਾਂਦਾ ਕੋਈ ਜਿੱਦਾਂ ਮਤਲਬ ਕਿ ਆਹਾ ਔਰ ਔ ਡਾਇਟਿੰਗ 'ਤੇ ਕਹਿ ਦਿੰਦੇ ਆ ਨਾ ਉਹ ਘੱਟ ਰੋਟੀ ਖਾਂਦੇ ਆ ਬਹੁਤ ਬਹੁਤ ਤੁਹਾਡਾ ਧੰਨਵਾਦ